ਸਤਿ ਸ਼੍ਰੀ ਅਕਾਲ ਜੀ ਮੈਂ ਹਫਤਾ ਪਹਿਲਾਂ ਇੱਕ ਕੁੜਤੀ ਮੰਗਵਾਈ ਸੀ ਉਸ ਦੀ ਪੈਕਿੰਗ ਵੀ ਵਧੀਆ ਨਹੀਂ ਸੀ ਅਤੇ ਉਸ ਦਾ ਰੰਗ ਵੀ ਵਧੀਆ ਨਹੀਂ ਸੀ ਉਸ ਦੀ ਕੁਆਲਿਟੀ ਵੀ ਵਧੀਆ ਨਹੀਂ ਸੀ ਜਦੋਂ ਮੈਂ ਉਹ ਪਾ ਕੇ ਦੇਖੀ ਤਾਂ ਉਸ ਦੀ ਫੀਟਿੰਗ ਵੀ ਵਧੀਆ ਨਹੀਂ ਸੀ ਉਸ ਦੀ ਸਿਲਾਈ ਵੀ ਵਧੀਆ ਨਹੀਂ ਕੀਤੀ ਹੋਈ ਸੀ ਉਸ 'ਤੇ ਲੈਸ ਬਹੁਤ ਹੀ ਘਟੀਆ ਲਗਾਈ ਹੋਈ ਸੀ ਅਤੇ ਮਾਰਕੀਟ ਨਾਲੋਂ ਮੈਨੂੰ ਮਹਿੰਗੀ ਦਿੱਤੀ ਗਈ ਮਾਰਕੀਟ ਵਿੱਚ ਉਸ ਦਾ ਰੇਟ ਪੰਜ ਸੌ ਸੀ ਅਤੇ ਤੁਸੀਂ ਮੈਨੂੰ ਅੱਠ ਸੌ ਦੀ ਦਿੱਤੀ ਅਤੇ ਬੱਚਿਆਂ ਨੇ ਵੀ ਉਹ ਕੁੜਤੀ ਪਸੰਦ ਨਹੀਂ ਕੀਤੀ ਅਤੇ ਸਾਡੇ ਗੁਆਂਢੀਆਂ ਨੇ ਵੀ ਉਹ ਕੁੜਤੀ ਬਿਲਕੁਲ ਵੀ ਪਸੰਦ ਨਹੀਂ ਕੀਤੀ ਜਾਂ ਤਾਂ ਤੁਸੀਂ ਮੇਰੇ ਪੈਸੇ ਵਾਪਸ ਕਰ ਦਿਓ ਨਹੀਂ ਤਾਂ ਜੋ ਮੈਂ ਰੰਗ ਪਸੰਦ ਕੀਤਾ ਸੀਗਾ ਉਹ ਹੀ ਰੰਗ ਮੈਨੂੰ ਭੇਜ ਦਿਓ ਧੰਨਵਾਦ ਜੀ